ਹੈਲੋ ਸਤਿ ਸ਼੍ਰੀ ਅਕਾਲ ਜੀ ਕੱਲ੍ਹ ਮੈਂ ਰੋਪੜ ਤੋਂ ਨਵਾਂਸ਼ਹਿਰ ਏਰੀਏ ਤੱਕ ਜਾਣ ਲਈ ਤੁਹਾਡੀ ਟਰਾਂਸਪੋਟ ਏਜੰਸੀ ਤੋਂ ਇੱਕ ਕੈਬ ਕਰਵਾਈ ਸੀ ਜਿਸ ਟਾਈਮ ਕੈਬ ਮੇਰੇ ਘਰ ਤੱਕ ਪਹੁੰਚੀ ਤਾਂ ਉਹ ਵੈਸੇ ਵੀ ਲੇਟ ਸੀ ਅਤੇ ਜਦੋਂ ਮੈਂ ਆਪਣੇ ਟਿਕਾਣੇ 'ਤੇ ਪਹੁੰਚਣਾ ਸੀ ਉਸ ਟਾਈਮ ਵੀ ਮੇਰਾ ਟਾਈਮ ਲੇਟ ਹੋ ਚੁੱਕਾ ਸੀ ਅਤੇ ਜਦੋਂ ਮੈਂ ਡਰਾਈਵਰ ਨੂੰ ਕਿਰਾਇਆ ਬਾਰੇ ਕਿਰਾਏ ਬਾਰੇ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਨਿਸ਼ਚਿਤ ਕਿਰਾਏ ਤੋਂ ਵੱਧ ਕਿਰਾਇਆ ਦੱਸਿਆ ਜਿਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਿਸ਼ਚਿਤ ਕਿਰਾਇਆ ਹੀ ਦੇਣਾ ਹੈ ਤਾਂ ਉਹਨਾਂ ਨੇ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਹੀ ਕਿਰਾਇਆ ਲਊਂਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਏਜੰਸੀ ਨਾਲ ਗੱਲ ਹੋ ਚੁੱਕੀ ਹੈ ਤਾਂ ਉਹਨਾਂ ਨੇ ਫਿਰ ਵੀ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਮੇਰੀ ਅਤੇ ਡਰਾਈਵਰ ਦੀ ਆਪਸ ਵਿੱਚ ਬਹੁਤ ਬਹਿਸ ਹੋਈ ਬਹਿਸ ਹੁੰਦੇ ਦੌਰਾਨ ਉਹਨਾਂ ਨੇ ਕੁਝ ਇਹੋ ਜਿਹੇ ਸ਼ਬਦ ਮੈਨੂੰ ਬੋਲੇ ਜੋ ਮੈਨੂੰ ਚੰਗੇ ਨਹੀਂ ਲੱਗੇ ਅਤੇ ਇਸ ਲਈ ਮੈਂ ਤੁਹਾਨੂੰ ਸ਼ਿਕਾਇਤ ਕਰਨ ਲਈ ਫੋਨ ਕੀਤਾ ਹੈ ਤਾਂ ਕਿ ਤੁਸੀਂ ਉਸ ਡਰਾਈਵਰ 'ਤੇ ਸਖਤ ਕਾਰਵਾਈ ਕਰ ਸਕੋ ਅਤੇ ਜਿੰਨਾ ਕਿਰਾਇਆ ਮੇਰਾ ਬਣਦਾ ਸੀ ਮੈਂ ਓਨਾ ਹੀ ਦਿੱਤਾ ਉਸ ਤੋਂ ਵੱਧ ਕਿਰਾਇਆ ਮੈਂ ਨਹੀਂ ਦੇਣਾ ਚਾਹਾਂਗੀ ਅਤੇ ਤੁਸੀਂ ਆਪਣੀ ਏਜੰਸੀ ਦੀ ਕੋਈ ਵੀ ਅੱਗੇ ਤੋਂ ਇਹੋ ਜਿਹੀ ਗੱਲ ਹੋਊਗੀ ਤਾਂ ਜ਼ਰੂਰ ਧਿਆਨ ਦਿਓ ਜੀ ਧੰਨਵਾਦ